ਕਲਾ ਦੀ ਅਹਿਮੀਅਤ ਜ਼ਿੰਦਗੀ 'ਚ ਬਹੁਤ ਹੁੰਦੀ ਹੈ ਕਲਾ ਤੋਂ ਬਗੈਰ ਜ਼ਿੰਦਗੀ ਇਹ ਸਮਝ ਲਓ ਕਿ ਅਧੂਰੀ ਹੈ ਜੇ ਬੰਦੇ 'ਚ ਕੋਈ ਵੀ ਕੰਮ ਕਰਨ ਦੀ ਕਲਾ ਹੈਗੀ ਹੈ ਤਾਂ ਉਹ ਫੇਰ ਹੀ ਉਹ ਕੰਮ ਨੂੰ ਪੂਰਾ ਕਰ ਸਕਦਾ ਜਾਂ ਅੱਗੇ ਵਧਾ ਸਕਦਾ ਕਲਾ ਤੋਂ ਬਗੈਰ ਆਪਦੇ ਇੰਟਰਸਟ ਤੋਂ ਬਗੈਰ ਕਲਾ ਵੀ ਨਹੀਂ ਆਉਂਦੀ ਜੇ ਆਪਾਂ ਨੂੰ ਕਲਾ ਆਉਂਦੀ ਹੈ ਤਾਂ ਫੇਰ ਹੀ ਉਹ ਕੰਮ ਵੀ ਅੱਗੇ ਉਹੀ ਪੂਰਾ ਹੁੰਦਾ ਕਲਾ ਤੋਂ ਬਗੈਰ ਇੱਕ ਹਿਸਾਬ ਲਾ ਲਉ ਵੀ ਜ਼ਿੰਦਗੀ ਅਧੂਰੀ ਹੈ

ਕਲਾ ਨਾਲ ਹੀ ਅਸਲ ਸਹੀ ਕੰਮ ਨੇਪਰੇ ਚੜ੍ਹਦਾ ਜੇ ਆਪਣੇ 'ਚ ਕਲਾ ਹੈ ਸਿੱਖਣ ਦੀ ਕਲਾ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਫੇਰ ਕੰਮ ਕਰਨ ਦੀ ਕਲਾ ਹੋਣੀ ਚਾਹੀਦੀ ਹੈ ਫੇਰ ਹੀ ਬੰਦੇ 'ਚ ਜਜ਼ਬਾ ਬਣਦਾ ਫੇਰ ਹੀ ਅੱਗੇ ਉਹ ਕੰਮ ਸੰਪੂਰਨ ਹੁੰਦਾ ਹੈਗਾ ਕਲਾ ਬਹੁਤ ਹੀ ਜ਼ਰੂਰੀ ਹੈ ਕਲਾ ਹਰੇਕ ਬੰਦੇ 'ਚ ਹੀ ਹੋਣੀ ਚਾਹੀਦੀ ਹੈ ਫੇਰ ਹੀ ਅੱਗੇ ਉਹ ਕੰਮ ਨੇਪਰੇ ਚੜ੍ਹ ਸਕਦਾ ਹੈਗਾ ਕਲਾ ਤੋਂ ਬਗੈਰ ਇੰਟਰਸਟ ਤੋਂ ਬਗੈਰ ਬੰਦਾ ਕੋਈ ਵੀ ਕੰਮ ਨਹੀਂ ਕਰ ਸਕਦਾ